ਮੈਂ ਡਾਂਸ ਰੀਲਾਂ ਦੇਖਦੀ ਹਾਂ ਕਿਉਂਕਿ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਘਰ ਵਿੱਚ ਟਾਈਮ ਨਹੀਂ ਲੱਗਦਾ ਕਿਉਂਕਿ ਬੱਚੇ ਬਹੁਤ ਛੋਟੇ ਹਨ ਇਸ ਕਰਕੇ ਮੈਂ ਡਾਂਸ ਰੀਲਾਂ ਦੇਖਦੀ ਹਾਂ ਡਾਂਸ ਰੀਲਾਂ ਦੇਖਣੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਕਿਉਂਕਿ ਉਹਨਾਂ ਦੇ ਨਾਲ ਮੇਰਾ ਮਨੋਰੰਜਨ ਹੋ ਜਾਂਦਾ ਹੈ ਫਰੀ ਟਾਈਮ ਵਿੱਚ ਜਦੋਂ ਘਰ ਮਨ ਨਹੀਂ ਲੱਗਦਾ ਉਦੋਂ ਮੈਂ ਆਪਣੀਆਂ ਡਾਂਸ ਰੀਲਾਂ ਦੇਖਦੀ ਹਾਂ ਸੋਸ਼ਲ ਮੀਡੀਆ 'ਤੇ ਮੈਨੂੰ ਮਹਿਮਾ ਚੌਧਰੀ ਡਾਂਸਰ ਬਹੁਤ ਪਸੰਦ ਹੈ ਕਿਉਂਕਿ ਉਹ ਬਹੁਤ ਸੋਹਣਾ ਡਾਂਸ ਕਰਦੀ ਹੈ ਉਸ ਨੂੰ ਆਪਣੇ ਇਸ ਡਾਂਸ ਖੇਤਰ ਵਿੱਚ ਆਉਣ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸਦੇ ਪੇਰੈਂਟਸ ਉਸਨੂੰ ਅਲਾਊਡ ਨਹੀਂ ਸੀ ਕਰਦੇ ਪਰ ਉਸਨੇ ਆਪਣੀ ਕਲਾ ਨੂੰ ਦਰਸਾਉਣ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਿਆ ਉਹ ਬਹੁਤ ਹੀ ਸੋਹਣਾ ਡਾਂਸ ਕਰਦੀ ਹੈ ਉਹ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਆਪਣੀ ਕਲਾ ਨੂੰ ਦਰਸਾਉਣ ਲਈ ਆਪਾਂ ਕੁਛ ਵੀ ਕਰੀਏ ਪਰ ਡਾਂਸ ਬਹੁਤ ਚੰਗਾ ਹੈ ਥੈਂਕ ਯੂ